ਜਦੋਂ ਮੈਂ ਆਪਣਾ ਸੂਟ ਸੀਨ ਲੱਗੀ ਤਾਂ ਮਸ਼ੀਨ ਦਾ ਧਾਗਾ ਟੁੱਟਣ ਨਾਲ ਟੁੱਟਣ ਲੱਗ ਪਿਆ ਤੇ ਮੈਨੂੰ ਲੱਗਾ ਕਿ ਸੂਈ ਬਦਲਣੀ ਚਾਹੀਦੀ ਹੈ ਪਰ ਇਹਨੂੰ ਫੇਰ ਮੈਂ ਇਹਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਧਾਗਾ ਟੁੱਟਣ ਲੱਗ ਗਿਆ ਤੇ ਮੈਂ ਇਸਨੂੰ ਤੇਲ ਦੇਣ ਦੀ ਕੋਸ਼ਿਸ਼ ਕੀਤੀ ਤੇਲ ਨਾਲ ਵੀ ਠੀਕ ਨਹੀਂ ਤੇ ਮੈਨੂੰ ਪਤਾ ਮੈਨੂੰ ਇਦਾਂ ਲੱਗਾ ਕਿ ਇਸ ਨੂੰ ਰਿਪੇਅਰ ਦੀ ਲੋੜ ਹੈ ਤੇ ਇਸ ਨੂੰ ਰਿਪੇਅਰ ਕੀਤਾ ਜਾਵੇ ਰਿਪੇਅਰ ਕਰਵਾਇਆ ਜਾਵੇ ਜਾਂ ਘਰ ਵਿੱਚ ਹੀ ਕੋਈ ਜੁਗਾੜ ਲਾਇਆ ਜਾਵੇ ਕਿ ਇਹ ਠੀਕ ਹੋ ਜਾਵੇ ਪਰ ਇਹ ਠੀ ਫਿਰ ਵੀ ਠੀਕ ਸੂਈ ਨਾ ਵੀ ਨਾ ਠੀਕ ਹੋਈ ਤੇ ਫਿਰ ਮੈਨੂੰ ਬਾਜ਼ਾਰ ਦੁਕਾਨਦਾਰ ਦੇ ਕੋਲ ਭੇਜਣਾ ਪਿਆ ਤੇ ਉਹਨੂੰ ਠੀਕ ਕਰਵਾਣਾ ਪਿਆ ਸੂਈ ਵੀ ਬਦਲ ਕੇ ਦੇਖ ਲਈ ਸਭ ਕੁਝ ਕਰਨ ਦੇ ਬਾਵਜੂਦ ਇਹ ਠੀਕ ਨਹੀਂ ਹੋ ਸਕੀ ਤੇ ਇਸ ਕਰਕੇ ਮੈਨੂੰ ਮਸ਼ੀਨ ਦੇ ਲੱਗਾ ਕਿ ਪੁਰਜਾ ਵੀ ਕੋਈ ਬਦਲਾਉਣਾ ਪਏਗਾ ਕਿ ਧਾਗਾ ਖਿੱਚਣ ਵੀ ਲੱਗ ਪਈ ਹੈ ਫਿਰ ਉਹਦੇ ਪੈਰਾਂ ਦੇ ਵਿੱਚ ਵੀ ਮਸ਼ੀਨ ਦੇ ਪੈਰ ਹੁੰਦੇ ਐ ਉਹਨਾਂ ਦੇ ਥੱਲੇ ਵੀ ਲਗਦਾ ਸੀ ਧਾਗਾ ਖਿੱਚਦੀ ਹ ਉਹਨਾਂ ਨੂੰ ਵੀ ਠੀਕ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਮੈਂ ਆਪਣੀ ਪੜੋਸਰ ਨੂੰ ਬੁਲਾ ਕੇ ਵੀ ਦਿਖਾਇਆ ਕਿ ਇਹ ਮਸ਼ੀਨ ਨੂੰ ਦੀ ਕੀ ਹੋ ਗਿਆ ਹੈ ਕਿ ਚਲਦੀ ਚਲਦੀ ਇਹ ਖਰਾਬ ਹੋ ਗਈ ਹੈ ਇਸ ਨੂੰ ਕੀ ਕੀਤਾ ਜਾ ਇਸ ਦਾ ਕੀ ਕੀਤਾ ਜਾਵੇ ਉਸ ਨੇ ਵੀ ਮੈਨੂੰ ਇਹੀ ਸਲਾਹ ਦਿੱਤੀ ਕਿ ਜਾ ਕੇ ਧੰਨ ਧੰਨਵਾਦ